ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਉਹਨਾਂ ਦੀ ਬਹੁਤ ਜ਼ਿਆਦਾ ਕਮੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੀ ਕਮੀ ਹੈ ਕਿ ਅਧਿਆਪਕ ਜਿਹੜੇ ਬਹੁਤ ਘੱਟ ਨੇ ਸੋ ਪੰਜਾਬ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਪੂਰਤੀ ਕੀਤੀ ਜਾਵੇ ਨਵੀਆਂ ਭਰਤੀਆਂ ਖੋਲ੍ਹੀਆਂ ਜਾਣ ਤਾਂ ਕਿ ਵੱਧ ਤੋਂ ਵੱਧ ਮਤਲਬ ਕਿ ਅਧਿਆਪਕ ਅਵੇਲੇਬਲ ਹੋਣ ਤਾਂ ਕਿ ਬੱਚਿਆਂ ਨੂੰ ਕੋਈ ਪ ਪੜ੍ਹਾਈ ਦੇ ਵਿੱਚ ਕਿਸੇ ਸਬਜੈਕਟ ਦੇ ਵਿੱਚ ਰੁਕਾਵਟ ਨਾ ਪਵੇ ਦੂਸਰੀ ਗੱਲ ਹਾਂ ਜਿਹੜੀ ਹਾਂ ਅ ਟੈਕਨੀਕਲ ਹਾਂਜੀ ਅਸੀਂ ਅ ਸਟੱਡੀ ਦੀ ਗੱਲ ਕਰੀਏ ਜਿੱਦਾਂ ਕਿ ਬਹੁਤ ਘੱਟ ਪੰਜਾਬ ਦੇ ਵਿੱਚ ਅਜਿਹੇ ਸਕੂਲ ਨੇ ਜਿਹਨਾਂ ਦੇ ਵਿੱਚ ਕਿ ਕੰਪਿਊਟਰ ਅਵੇਲੇਬਲ ਹਨ ਸੋ ਵੱਧ ਤੋਂ ਵੱਧ ਜੇਕਰ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਕੰਪਿਊਟਰ ਅਵੇਲੇਬਲ ਕਰਵਾਏ ਜਾਣ ਤਾਂ ਕਿ ਬੱਚੇ ਕੰਪਿਊਟਰ ਸਿੱਖ ਸਕਣ ਬੱਚੇ ਨਵੀਂ ਟੈਕਨੋਲਜੀ ਦੀ ਸਟੱਡੀ ਕਰ ਸਕਣ ਅਤੇ ਦੂਸਰੀ ਗੱਲ ਪੰਜਾਬ ਦੇ ਸਕੂਲਾਂ ਦੀ ਜਿਹੜੀ ਬਿਲਡਿੰਗ ਹੈ ਉਹ ਜੋ ਬਹੁਤ ਜ਼ਿਆਦਾ ਪੁਰਾਣੀ ਕਈ ਸਕੂਲਾਂ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ ਕਮਰੇ ਬਹੁਤ ਪੁਰਾਣੇ ਹੋ ਚੁੱਕੇ ਨੇ ਕਮਰੇ ਹਵਾਦਾਰ ਨਹੀਂ ਹਨ ਕਮਰੇ ਨੀਵੇਂ ਹੋ ਚੁੱਕੇ ਹਨ ਸੋ ਕਮਰਿਆਂ ਦੀ ਚੰਗੀ ਤਰ੍ਹਾਂ ਜਾਂ ਤਾਂ ਮੁਰੰਮਤ ਕਰਵਾਈ ਜਾਵੇ ਉਹਨਾਂ ਦੇ ਵਿੱਚ ਏ ਸੀ ਲਵਾਇਆ ਜਾਵੇ ਐਂਡ ਨਵੇਂ ਕਮਰੇ ਬਣਵਾਏ ਜਾਣ ਨਵੀਆਂ ਲਾਈਬ੍ਰੇਰੀਆਂ ਬਣਾਈਆਂ ਜਾਣ ਲਾਈਬ੍ਰੇਰੀਆਂ ਦੇ ਵਿੱਚ ਨਵੀਆਂ ਬੁੱਕਸ ਅਵੇਲੇਬਲ ਕੀਤੀਆਂ ਜਾਣ ਤਾਂ ਕਿ ਬੱਚੇ ਨਵੀਆਂ ਬੁੱਕਸ ਪੜ੍ਹ ਸਕਣ ਐਂਡ ਉਹਨਾਂ ਦੇ ਸਿਲੇਬਸ ਦੇ ਵਿੱਚ ਨਵੀਆਂ ਬੁੱਕਸ ਲਗਾਈਆਂ ਜਾਣ